ਸਰਕਾਰ ਦੁਆਰਾ ਸਾਨੂੰ ਕਈ ਸਾਰੀਆ ਸਕੀਮਾਂ ਦਿੱਤੀਆ ਜਾਂਦੀਆ ਹਨ ਜਿਵੇਂ ਕਿ ਰਾਸ਼ਨ ਕਾਰਡ ਅਤੇ ਨੀਲਾ ਕਾਰਡ ਅਤੇ ਪੀਲੇ ਕਾਰਡ ਦੀ ਸਕੀਮ ਰਾਸ਼ਨ ਕਾਰਡ ਦੀ ਸਕੀਮ ਵਿੱਚ ਸਾਨੂੰ ਰਾਸ਼ਨ ਬਹੁਤ ਵਧੀਆ ਮਿਲਦਾ ਹੈ ਅਤੇ ਜਿਵੇਂ ਕਿ ਬਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ 'ਤੇ ਮਿਲਦਾ ਹੈ ਅਤੇ ਵਧੀਆ ਵੀ ਹੁੰਦਾ ਹੈ ਅਤੇ ਲਾਲ ਪੀਲਾ ਅਤੇ ਨੀਲੇ ਕਾਰਡ ਦੀ ਵਰਤੋਂ ਨਾਲ਼ ਸਾਨੂੰ ਰਜਿਸਟਰਡ ਹੋਸਪੀਟਲ ਵਿੱਚ ਪੰਜ ਤੋਂ ਦਸ ਲੱਖ ਦੇ ਵਿੱਚ ਸਾਡਾ ਇਲਾਜ ਬਿਲਕੁਲ ਫ਼ਰੀ ਹੁੰਦਾ ਹੈ